ਹੈਲੋ ਬਲਰਾਜ ਸਰ ਬੋਲਦੇ ਹੋ ਜੀ ਅਸੀਂ ਨਾ ਜੀ ਫੁਰਸਤ ਤੋਂ ਨਾ ਪੀਜ਼ਾ ਬੁੱਕ ਕਰਵਾਇਆ ਸੀ ਫੋਨ 'ਤੇ ਚੈੱਕ ਕਰਿਆ ਵੀ ਪੁ ਪੀਜ਼ਾ ਬੁੱਕ ਹੋ ਗਿਆ ਵੀ ਚੱਲ ਪਿਆ ਵੀ ਹਾਲੇ ਪੰਜ ਮਿੰਟ ਤੱਕ ਪਹੁੰਚ ਜੂਗਾ ਪਹੁੰਚਿਆ ਹੈ ਨਹੀਂ ਵੀ ਜੇ ਬੰਦਾ ਤੁਰ ਕੇ ਆਵੇ ਉਹ ਵੀ ਪੰਜ ਮਿੰਟ 'ਚ ਪਹੁੰਚ ਸਕਦਾ ਹੈ ਵੈਸੇ ਅੱਧਾ ਘੰਟਾ ਹੋ ਗਿਆ ਜੀ ਮੈਂ ਡਿਊਟੀ 'ਤੇ ਜਾਣਾ ਸੀ ਸਾਡਾ ਸਾਹਿਬ ਬਹੁਤ ਸਖਤ ਆ ਵੀ ਵੀ ਛੇਤੀ ਤੋਂ ਛੇਤੀ ਸਾਡੇ ਕੋਲ ਦੇਖੋ ਤੁਸੀਂ ਵੀ ਉਹ ਕਿੱਥੇ ਰਹਿ ਗਿਆ ਜੀ ਫੋਨ ਕਰਕੇ ਪੁੱਛੋ ਉਹਨਾਂ ਨੂੰ